ਬਚਪਨ ਵਿੱਚ ਬਚਪਨ ਤੋਂ ਹੀ ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਕ ਹੈ ਅਤੇ ਬਚਪਨ ਵਿੱਚ ਇੱਕ ਕੈਮਬਲੀਨ ਕੰਟੈਸਟ ਆਉਂਦਾ ਹੁੰਦਾ ਸੀ ਅਤੇ ਜਿਹਦੇ ਵਿੱਚ ਅਸੀਂ ਆਪਣੀਆਂ ਬਣਾਈਆਂ ਹੋਈਆਂ ਕੋਈ ਵੀ ਪੇਂਟਿੰਗਜ਼ ਉਹ ਭੇਜਦੇ ਹੁੰਦੇ ਸੀਗੇ ਅਤੇ ਉਹਦੇ ਵਿੱਚ ਮੇਰੇ ਬਹੁਤ ਸਾਰੇ ਪ੍ਰਾਈਜਸ ਵੀ ਨਿਕਲੇ ਹਨ ਪਰ ਜਦੋਂ ਦੇ ਵੱਡੇ ਹੋਏ ਹਾਂ ਹੁਣ ਕੰਮ ਜਿਹੜਾ ਪੇਂਟਿੰਗਸ ਮੈਂ ਆਪਣੇ ਮਨ ਪਰਚਾਵੇ ਲਈ ਹੀ ਕਰਦੀ ਹਾਂ ਹੁਣ ਤਾਂ ਨਹੀਂ ਕੋਈ ਸਕੂਲ ਜਾਂ ਕਾਲਜ ਵਿੱਚ ਮੈਂ ਮੇਰੇ ਕੋਈ ਪ੍ਰਕਾਸ਼ਿਤ ਹੋਏ ਪਰ ਹਾਂ ਇੰਨਾਂ ਹੈ ਕਿ ਮੈਂ ਆਪਣੇ ਸ਼ੌਂਕ ਲਈ ਅਤੇ ਆਪਣੇ ਮਨ ਪਰਚਾਵੇ ਲਈ ਅਤੇ ਐਸ ਆ ਹੋਬੀ ਮੈਂ ਉਹਨੂੰ ਬਣਾਉਦੀ ਹਾਂ ਪੇਂਟਿੰਗਜ਼ ਅਤੇ ਪੇਂਟਿੰਗਸ ਜਿਹੜੀਆਂ ਨੇ ਉਹ ਮੈਂ ਸੰਭਾਲ ਕੇ ਵੀ ਰੱਖਦੀ ਹਾਂ ਅਤੇ ਵਿਸ਼ਾ ਅਤੇ ਪਿਛੋਕੜ ਕੋਈ ਵੀ ਹੋ ਸਕਦਾ ਹੈ ਪਿਛੋਕੜ ਇਸ ਕਰਕੇ ਮੈਂ ਚੈਕਲੇਨ ਕੁਝ ਪਿੰਡਾਂ ਦੀਆਂ ਤਸਵੀਰਾਂ ਕੁਝ ਖੇਤਾਂ ਦੀਆਂ ਉਹਦੇ ਵਿੱਚ ਮੈਂ ਚੱਕ ਲੈਣ ਤਾਂ ਕਿ ਆਉਣ ਵਾਲਾ ਵਿਰਸਾ ਜਿਹੜਾ ਹੈਗਾ ਜਿਹੜਾ ਵਿਰਸਾ ਮੈਂ ਦੇਖਿਆ ਹੈ ਛੋਟੇ ਹੁੰਦੇ ਵੀ ਉਹ ਮੇਰੇ ਕੋਲ ਸਾਰਾ ਸੰਭਾਲਿਆ ਵੀ ਹੋਏ ਪੇਂਟਿੰਗ ਦੇ ਫੋਰਮ ਵਿੱਚ ਅਤੇ ਮੈਂ ਆਉਣ ਵਾਲੇ ਆਪਣੇ ਜਨਰੇਸ਼ਨ ਜਿਹੜੀਆਂ ਜਿਵੇਂ ਆਪਣੇ ਬੱਚੇ ਉਹਨਾਂ ਦੇ ਬੱਚਿਆਂ ਨੂੰ ਵੀ ਮੈਂ ਦਿਖਾ ਸਕਾਂ ਤੇ ਉਹ ਪੇਂਟਿੰਗ ਮੇਰੇ ਕੋਲ ਜਿਹੜੀਆਂ ਨੇ ਹਾਲੇ ਤੱਕ ਉਹ ਮੇਰੇ ਕੋਲ ਸੰਭਾਲ ਕੇ ਹੀ ਮੈਂ ਰੱਖਣਾ ਚਾਹੁੰਦੀ ਹਾਂ